ਛੋਟੇ ਕਾਰੋਬਾਰ ਉਹ ਹੁੰਦੇ ਹਨ ਜੋ ਕਿ ਬਹੁਤ ਘੱਟ ਖਰਚੇ 'ਤੇ ਅਤੇ ਬਹੁਤ ਘੱਟ ਮਜ਼ਦੂਰਾਂ ਦੀ ਵਰਤੋਂ ਕਰਕੇ ਚਲਾਇਆ ਜਾ ਸਕਦਾ ਹੈ ਅੱਜ ਦੇ ਜ਼ਮਾਨੇ ਵਿੱਚ ਵੱਡੇ ਵੱਡੇ ਕਾਰਖਾਨੇ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਰਹੇ ਹਨ ਛੋਟੇ ਕਾਰੋਬਾਰ ਵਿੱਚ ਜਿਵੇਂ ਹੱਥਾਂ ਦੇ ਬਣੇ ਚੀਜ਼ਾਂ ਦਾ ਬਹੁਤ ਮਹੱਤਵ ਸੀ ਹੱਥਾਂ ਦੇ ਬਣੇ ਚੀਜ਼ਾਂ ਦੀ ਜਿਵੇਂ ਕਿ ਦਰੀਆਂ ਬੁਣਨਾ ਕੁਰਸੀਆਂ ਬੁਣਨਾ ਟੋਕਰੇ ਬਣਾਉਣੇ ਆਦਿ ਛੋਟੇ ਕਾਰੋਬਾਰ ਵਿੱਚ ਸ਼ਾਮਿਲ ਸੀ ਪਰ ਅੱਜ ਕੱਲ੍ਹ ਲੋਕ ਫੈਕਟਰੀਆਂ 'ਤੇ ਜ਼ਿਆਦਾ ਨਿਰਭਰ ਕਰਕੇ ਹੱਥ ਦੀਆਂ ਬਣੀਆਂ ਚੀਜ਼ਾਂ ਨੂੰ ਵਰਤੋਂ ਬਹੁਤ ਘੱਟ ਕਰਦੇ ਹਨ ਪਰ ਛੋਟੇ ਕਾਰੋਬਾਰ ਵਿੱਚ ਇਹ ਬਹੁਤ ਲਾਹੇਵੰਦ ਕਾਰੋਬਾਰ ਹੈ ਜਿਵੇਂ ਕਿ ਘੁੰਮਿਆਰਾਂ ਦੁਆਰਾ ਕ ਹ ਹੱਥੀਂ ਘੜੇ ਬਣਾਏ ਜਾਂਦੇ ਹਨ ਭਾਂਡੇ ਬਣਾਏ ਜਾਂਦੇ ਹਨ ਇਹ ਕਾਰੋਬਾਰ ਬਹੁਤ ਲਾਹੇਵੰਦ ਕਾਰੋਬਾਰ ਹੈ